ਇਹ ਗੱਲ ਬਿਲਕੁਲ ਸੱਚ ਹੈ ਕਿ ਮਨੁੱਖ ਹਮੇਸ਼ਾ ਆਪਣੇ ਜੜ੍ਹਾਂ ਨਾਲ ਜੁੜਨਾ ਚਾਹੁੰਦਾ ਹੈ ਜਿਵੇਂ ਕਿ ਮੈਨੂੰ ਆਪਣੀ ਸਿੱਖੀ ਧਰਮ ਬਾਰੇ ਬਹੁਤ ਜ਼ਿਆਦਾ ਜੋ ਮਾਣ ਮਹਿਸੂਸ ਹੁੰਦਾ ਹੈ ਕਿ ਹਾਂ ਮੈਂ ਸਿੱਖ ਕੌਮ ਵਿੱਚ ਪੈਦਾ ਹੋਈ ਹਾਂ ਇਸੇ ਸਿੱਖ ਧਰਮ ਨਾਲ਼ ਜੁੜ ਕੇ ਮੈਨੂੰ ਕਈ ਤਰ੍ਹਾਂ ਦਾ ਇਤਿਹਾਸ ਬਾਰੇ ਪਤਾ ਲੱਗਦਾ ਹੈ ਗੁਰੂਆਂ ਦੀ ਸ਼ਹੀਦੀ ਬਾਰੇ ਪਤਾ ਲੱਗਦਾ ਹੈ ਜੋ ਕਿ ਸਾਨੂੰ ਸਵੇਰੇ ਉੱਠ ਕੇ ਪਾਠ ਕਰਨ ਦੀ ਜੋ ਪ੍ਰੇਰਣਾ ਦਿੰਦੇ ਹਨ ਇਸ ਤੋਂ ਬਿਨਾਂ ਜੋ ਇੱਕ ਮੇਰੀ ਜ਼ਿੰਦਗੀ ਦਾ ਅਜਿਹਾ ਪਲ ਹੈ ਉਹ ਹੈਗੇ ਨੇ ਮੇਰੇ ਦਾਦਾ ਦਾਦੀ ਜੋ ਕਿ ਸਾਨੂੰ ਬਹੁਤ ਹੀ ਵਧੀਆ ਥਾਵਾਂ 'ਤੇ ਮਤਲਬ ਰਾਹਾਂ 'ਤੇ ਚੱਲਣਾ ਸਿਖਾਉਂਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਉਹਨਾਂ ਨੇ ਨਕਾਰਤਮਕ ਨਹੀਂ ਸੋਚਿਆ ਹਮੇਸ਼ਾ ਹੀ ਪੋਜ਼ੀਟਿਵ ਸੋਚਿਆ ਹੈ ਅਤੇ ਪੋਜ਼ੀਟਿਵ ਰਹਿਣ ਬਾਰੇ ਹੀ ਕਿਹਾ ਹੈ ਉਹਨਾਂ ਦੀਆਂ ਗੱਲਾਂ ਅੱਜ ਵੀ ਕਈ ਥਾਵਾਂ 'ਤੇ ਮੈਨੂੰ ਯਾਦ ਆਉਂਦੀਆਂ ਹਨ ਜਿਸ ਦੇ ਨਾਲ਼ ਮੈਂ ਬਹੁਤ ਹੀ ਜ਼ਿਆਦਾ ਪ੍ਰੇਰਿਤ ਹੁੰਦੀ ਹਾਂ ਸਾਨੂੰ ਆਪਣੇ ਮਾਂ ਬਾਪ ਤੋਂ ਵੀ ਡਰ ਰੱਖਣਾ ਚਾਹੀਦਾ ਹੈ ਪ ਪੰਜਾਬੀ ਕਲਚਰ ਦੇ ਵਿੱਚ ਜੋ ਹੈ ਰਿਸ਼ਤਿਆਂ ਦੀ ਬਹੁਤ ਇੱਜ਼ਤ ਹੁੰਦੀ ਹੈ ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਇਸ ਦੇ ਕਾਰਨ ਹੀ ਅਸੀਂ ਇੱਕ ਦੂਜੇ ਨਾਲ ਵਧੀਆ ਤਰੀਕੇ ਨਾਲ਼ ਜੁੜੇ ਰਹਿੰਦੇ ਹਾਂ